ਮੈਨੂੰ ਸਿੰਗਿੰਗ ਦਾ ਹੁਨਰ ਹੈ ਮੈਂ ਬਹੁਤ ਵਧੀਆ ਗਾਣਾ ਗਾਉਂਦੀ ਹਾਂ ਅਤੇ ਸ਼ੁਰੂਆਤ ਤੋਂ ਹੀ ਮੈਨੂੰ ਗਾਣਾ ਗਾਉਣ ਦਾ ਬਹੁਤ ਹੀ ਸ਼ੌਕ ਹੈ ਜਦ ਮੈਂ ਸਕੂਲ 'ਚ ਐਡਮਿਸ਼ਨ ਕਰਵਾਇਆ ਉੱਥੇ ਕਾਫੀ ਫੰਕਸ਼ਨ ਹੁੰਦੇ ਸੀਗੇ ਅਤੇ ਮੈਂ ਹਰੇਕ 'ਚ ਪਾਰਟੀਸਪੇਟ ਕਰਦੀ ਸੀ ਏਟਥ ਕਲਾਸ 'ਚ ਮੈਨੂੰ ਯਾਦ ਹੈ ਕਿ ਮੈਂ ਮਿਊਜ਼ਕ ਮਿਊਜ਼ਿਕ ਰੱਖਿਆ ਅਤੇ ਉਸ ਮਿਊਜ਼ਿਕ ਨੇ ਹੁਣ ਮੈਨੂੰ ਐਨਾ ਮਹੱਤਵਪੂਰਨ ਬਣਾ ਤਾ ਕਿ ਮੈਂ ਕਿਤੇ ਵੀ ਇਕੱਲੀ ਹੋ ਕੇ ਵੀ ਗਾਣਾ ਗਾ ਸਕਦੀ ਹਾਂ ਮੈਂ ਮੇਰੇ 'ਚ ਐਨੀ ਹਿੰਮਤ ਹੋ ਗਈ ਹੈ ਅਤੇ ਮੈਂ ਹੁਣ ਕੋਲੇਜ 'ਚ ਹੋ ਗਈ ਹਾਂ ਅਤੇ ਯੂਥ ਜਾਂ ਉੱਥੇ ਜਦ ਯੂਥ ਫੈਸਟੀਵਲ ਹੁੰਦਾ ਹੈ ਅਤੇ ਮੈਂ ਉੱਥੇ ਵੀ ਬੇਝਿਜਕ ਹੋ ਕੇ ਪਾਰਟੀਸਪੇਟ ਕਰ ਲੈਂਦੀ ਹਾਂ ਮੈਨੂੰ ਕਿਸੇ ਦੂਜੇ ਦੀ ਮੈਨੂੰ ਇਹ ਨਹੀਂ ਕਿ ਹਾਂ ਮੈਂ ਇਕੱਲੇ ਹੋਣ 'ਚ ਮੈਨੂੰ ਸ਼ਰਮ ਹੈ ਮੈਨੂੰ ਬਹੁਤ ਵਧੀਆ ਹੁਣ ਟੈਲੈਂਟ ਦਾ ਟੈਲੈਂਟ ਮਿਲਿਆ ਉੱਥੋਂ ਮੈਂ ਹੁਣ ਮੈਨੂੰ ਗਾਣੇ ਗਾਉਣ ਦਾ ਬਹੁਤ ਸ਼ੌਕ ਹੈ ਅਤੇ ਹੁਣ ਮੈਂ ਕਿਤੇ ਵੀ ਜਦ ਮੈਂ ਫ਼ੋਨ ਵਗੈਰਾ 'ਚ ਗਾਣਾ ਲਗਾਉਂਦੀ ਹਾਂ ਅਤੇ ਮੈਨੂੰ ਗਾਉਣ ਦਾ ਸ਼ੌਕ ਹੈ ਬਹੁਤ ਅਤੇ ਮੈਂ ਉੱਥੋਂ ਹੀ ਸ਼ੁਰੂ ਹੋ ਜਾਂਦੀ ਹਾਂ ਗਾਣਾ ਗਾਉਣ ਲਈ ਅਤੇ ਮੈਨੂੰ ਉਸ ਸਿੰਗਿੰਗ ਨੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਬਣਾ